ਸਾਡੇ ਖੇਤਰ ਵਿੱਚ ਜ਼ਿਆਦਾਤਰ ਪੰਜਾਬੀ ਸੂਟ ਕੁੜਤੇ ਪਜਾਮੇ ਸਿਲਾਈ ਕੀਤੇ ਜਾਂਦੇ ਹਨ ਅਤੇ ਕੋਟੀਆਂ ਸਵੈਟਰ ਅਲੱਗ ਅਲੱਗ ਡਿਜ਼ਾਈਨਾਂ ਨਾਲ ਬੁਣੇ ਜਾਂਦੇ ਹਨ ਇਹਨਾਂ ਸਵੈਟਰਾਂ ਨੂੰ ਮਸ਼ੀਨਾਂ ਜਾਂ ਹੱਥਾਂ ਨਾਲ ਬਣਾਇਆ ਜਾਂਦਾ ਹੈ ਮੇਰੀ ਨਨਾਣ ਦੇ ਵਿਆਹ ਵਿੱਚ ਮੈਂ ਜਾਗੋ ਲਈ ਇੱਕ ਰਵਾਇਤੀ ਕਮੀਜ਼ ਅਤੇ ਘੱਗਰਾ ਸਿਲਾਈ ਕੀਤਾ ਸੀ ਜੋ ਕਿ ਸਭ ਨੂੰ ਬਹੁਤ ਪਸੰਦ ਆਇਆ ਸੀ ਮੈਂ ਕਮੀਜ਼ ਦੇ ਨਾਲ ਦੀ ਕਢਾਈ ਘੱਗਰੇ ਦੇ ਘੇਰੇ ਵਿੱਚ ਕੀਤੀ ਸੀ ਅਤੇ ਚੁੰਨੀ 'ਤੇ ਗੋਟਾ ਪੱਤੀ ਦਾ ਕੰਮ ਅਤੇ ਕਢਾਈ ਕੀਤਾ ਸੀ ਇਸ ਦਾ ਕੰਮ ਬਹੁਤ ਹੀ ਵਧੀਆ ਕੀਤਾ ਗਿਆ ਸੀ ਅਤੇ ਇਸਦਾ ਰੰਗ ਵੀ ਅਲੱਗ ਜਿਹਾ ਸੀ ਇਹ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਸੀ